ਮੈਨੂੰ ਲੱਗਦਾ ਬੱਚਿਆਂ ਨੂੰ ਪੇਂਟਿੰਗ ਜਾਂ ਡਰਾਇੰਗ ਕਰਨ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਸਹੀ ਉਮਰ ਪੰਜ ਕੁ ਸਾਲ ਦੇ ਕਰੀਬ ਹੁੰਦੀ ਹੈ ਜਦੋਂ ਬੱਚਾ ਕਲਰ ਫੜ ਕੇ ਉਹਨਾਂ ਨੂੰ ਚਲਾਉਣੇ ਸਿੱਖਦਾ ਅਤੇ ਆਪਣੀਆਂ ਜਿਹੜੀਆਂ ਡਰਾਇੰਗ ਕਰਨੀ ਸਿੱਖਦਾ ਆਪਣੀ ਜਿਹੜੀ ਕਲਾ ਉਹਨੂੰ ਬਾਹਰ ਕੱਢਦਾ ਹੌਲੀ ਹੌਲੀ ਉਹ ਇਸ ਚੀਜ਼ ਦੇ ਵਿੱਚ ਪੂਰਾ ਮਸ਼ਹੂਰ ਹੁੰਦਾ ਅਤੇ ਹੌਲੀ ਹੌਲੀ ਉਹ ਜਿਹੜੀਆਂ ਪੇਂਟਿੰਗਸ ਬਣਾਉਂਦਾ ਫਲਾਵਰਸ ਬਣਾਉਂਦਾ ਫੁੱਲ ਬੂਟੇ ਬਣਾਉਂਦਾ ਜਿਹਨਾਂ ਰਾਹੀਂ ਉਹ ਕਈ ਚੀਜ਼ਾਂ ਉਹ ਇਵੇਂ ਦੀਆਂ ਬਣਾਉਂਦਾ ਕਿ ਉਹ ਕਲਾ ਦੇ ਵਿੱਚ ਸਾਨੂੰ ਚੀਜ਼ ਦੇ ਬਾਰੇ ਪਤਾ ਚੱਲਦਾ ਵੀ ਇਹ ਕੀ ਦੱਸ ਰਹੀ ਹੈ ਬੱਚਿਆਂ ਨੂੰ ਇਹ ਸ਼ੌਂਕ ਹੋਣਾ ਬਹੁਤ ਵਧੀਆ ਇਹਦੇ ਨਾਲ਼ ਬੱਚੇ ਚੰਗੀਆਂ ਪੇਂਟਿੰਗਸ ਬਣਾ ਕੇ ਉਹਨਾਂ ਨੂੰ ਸੇਲ ਕਰਕੇ ਜਿਹੜਾ ਪੈਸਾ ਵੀ ਕਮਾ ਸਕਦੇ ਆ ਜਿਹਦੇ ਨਾਲ਼ ਉਹਨਾਂ ਦੀ ਅਰਨਿੰਗ ਚੰਗੀ ਹੋਣ ਲੱਗ ਜਾਂਦੀ ਹੈ ਅਤੇ ਇੱਕ ਉਹਨਾਂ ਦਾ ਨਾਮ ਵੀ ਬਣਦਾ ਚੰਗੀਆਂ ਪੇਂਟਿੰਗਸ ਜਿਹੜੀਆਂ ਜਿਸ ਬਜ਼ਾਰ 'ਚੋਂ ਖਰੀਦਣੀਆਂ ਹੋਣ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ